ਭੰਗੜਾ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਇਸ ਦੀ ਪ੍ਰਫੁਲਤਾ ਵਾਸਤੇ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੇ ਰੱਖਣ ਜਾਣ ਵਾਸਤੇ ਭੰਗੜੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਪ੍ਰਸਿੱਧ ਮੁਕਾਬਲਾ ਕਾਲਜਾਂ ਵਿੱਚ ਕਰਵਾਇਆ ਜਾਣ ਵਾਲ਼ਾ ਯੁਵਾ ਮੇਲਾ ਹੈ ਜਿਸ ਵਿੱਚ ਅਲੱਗ ਅਲੱਗ ਕਾਲਜਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ ਅਤੇ ਅਲੱਗ ਅਲੱਗ ਕਾਲਜਾਂ ਦੇ ਬੱਚੇ ਭਾਗ ਲੈਂਦੇ ਹਨ ਇਸ ਵਿੱਚ ਅਲੱਗ ਅਲੱਗ ਕਾਲਜਾਂ ਦੇ ਬੱਚੇ ਅਲੱਗ ਅਲੱਗ ਸ਼੍ਰੇਣੀਆਂ ਵਿੱਚ ਭਾਗ ਲੈਂਦੇ ਹਨ ਫਿਰ ਆਹਾ ਸ਼੍ਰੇਣੀਆਂ ਵਿੱਚੋਂ ਜਿੱਤ ਕੇ ਅਗਲੀ ਸ਼੍ਰੇਣੀ ਵਿੱਚ ਪਹੁੰਚ ਜਾਂਦੇ ਹਨ ਇਹਨਾਂ ਵਿੱਚ ਪਹਿਲਾਂ ਦੌਰ ਕੋਲਜ ਲੈਵਲ ਹੁੰਦਾ ਹੈ ਜਿਸ ਵਿੱਚ ਅਲੱਗ ਅਲੱਗ ਕਾਲਜ ਅਪ ਦੂਸਰੇ ਕਾਲਜ ਨਾਲ਼ ਮੁਕਾਬਲਾ ਕਰਦੇ ਹਨ ਅਤੇ ਫਿਰ ਅਗਲੀ ਸ਼੍ਰੇਣੀ ਵਿੱਚ ਪਹੁੰਚ ਜਾਂਦੇ ਹਨ ਅਗਲੀ ਸ਼੍ਰੇਣੀ ਯੂਨੀਵਰਸਿਟੀ ਲੈਵਲ ਹੁੰਦੀ ਹੈ ਜਿਸ ਵਿੱਚ ਅਲੱਗ ਅਲੱਗ ਯੂਨੀਵਰਸਿਟੀਆਂ ਆਪਸ ਵਿੱਚ ਮੁਕਾਬਲਾ ਕਰਦੀਆਂ ਹਨ ਅਤੇ ਫਿਰ ਅਗਲੀ ਸ਼੍ਰੇਣੀ ਜੋ ਕੀ ਨੈਸ਼ਨਲ ਲੈਵਲ ਹੈ ਵਿੱਚ ਪਹੁੰਚ ਜਾਂਦੀਆਂ ਹਨ ਜੋ ਕੋ ਯੂਨੀਵਰਸਿਟੀ ਇਸ ਲੈਵਲ ਵਿੱਚ ਜਿੱਤ ਜਾਂਦੀਆਂ ਹਨ ਉਨ੍ਹਾਂ ਨੂੰ ਨੈਸ਼ਨਲ ਲੈਵਲ ਤੇ ਨੱਚੇ ਜਾਣ ਦਾ ਮੌਕਾ ਮਿਲਦਾ ਹੈ